ਅਸੀਂ ਆਪਣੇ ਜੀਵਨ ਵਿੱਚ ਦੌੜਨ ਨਾਲ ਆਪਣੀ ਮਾਨਸਿਕ ਸਿਹਤ ਅਤੇ ਤੰਦਰੁਸਤੀ 'ਤੇ ਬਹੁਤ ਸਕਾਰਾਤਮਕ ਤਰੀਕੇ ਨਾਲ ਪ੍ਰਭਾਵ ਪਾਉਂਦਾ ਹੈ ਅਸੀਂ ਦੋੜਨ ਤੋਂ ਬਾਅਦ ਬਹੁਤ ਹੀ ਆਰਾਮ ਮਹਿਸੂਸ ਕਰਦੇ ਹਾਂ ਦੌੜਨ ਨਾਲ ਮਾਨਸਿਕ ਸਿਹਤ ਅਤੇ ਤੰਦਰੁਸਤੀ ਪੈਦਾ ਹੁੰਦੀ ਹੈ ਜਿਸ ਨਾਲ ਤਨਾਓ ਬਹੁਤ ਘੱਟ ਜਾਂਦਾ ਹੈ ਦੌੜਨਾ ਇੱਕ ਆਨੰਦ ਹਰਮੋਨ ਦਾ ਸਤਰ ਬਹੁਤ ਜ਼ਿਆਦਾ ਵਧਾਉਂਦਾ ਹੈ ਜੋ ਕਿ ਤਨਾਓ ਅਤੇ ਚਿੰਤਾ ਨੂੰ ਸਾਡੇ ਜੀਵਨ ਵਿੱਚੋਂ ਬਹੁਤ ਹੀ ਘੱਟ ਹੁੰਦਾ ਹੈ ਇਸ ਨਾਲ ਸਾਡੇ ਮੂਡ ਨੂੰ ਬਿਹਤਰ ਬਣਾਉਂਦਾ ਹੈ ਇਸ ਨਾਲ ਜ਼ਿਆਦਾ ਵਧੀਆ ਨੀਂਦ ਵੀ ਆਉਂਦੀ ਹੈ ਜੇਕਰ ਅਸੀਂ ਨਿਯਮਤ ਸਮੇਂ ਦੇ ਅਨੁਸਾਰ ਦੌੜਦੇ ਹਾਂ ਤਾਂ ਆਪਣੇ ਜੀਵਨ ਦੇ ਵਿੱਚ ਨੀਂਦ ਦੇ ਮਿਆਰ ਨੂੰ ਵੀ ਬਹੁਤ ਹੀ ਜ਼ਿਆਦਾ ਸੁਧਾਰ ਸਕਦੇ ਹਾਂ ਜਿਸ ਨਾਲ ਪੂਰੀ ਤਰ੍ਹਾਂ ਆਰਾਮ ਅਤੇ ਤੰਦਰੁਸਤੀ ਸਾਡੇ ਜੀਵਨ ਵਿੱਚ ਸੁਧਾਰ ਦਿੰਦੀ ਹੈ ਇਸ ਨਾਲ ਆਤਮਿਕ ਮੁੱਲ ਵੀ ਵੱਧਦਾ ਹੈ ਦੌੜਨਾ ਅਤੇ ਆਪਣੇ ਲੱਕੜੀ ਅਤੇ ਟੀਚਿਆਂ ਦੇ ਅਨੁਸਾਰ ਪ੍ਰਾਪਤ ਕਰਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰਦਾ ਹੈ ਜੋ ਕਿ ਆਤਮਿਕ ਮੁੱਲ ਅਤੇ ਆਤਮ ਸੰਤੋਸ਼ ਵਿੱਚ ਵੀ ਵਾਧਾ ਹੁੰਦਾ ਹੈ ਤੰਦਰੁਸਤੀ ਜੀਵਨ ਸ਼ੈਲੀ ਵੱਧਦੀ ਹੈ ਦੌੜਨਾ ਸਰੀਰਕ ਤੰਦਰੁਸਤੀ ਨੂੰ ਸੁਧਾਰਦਾ ਹੀ ਰਹਿੰਦਾ ਹੈ ਦਿਲ ਅਤੇ ਫੇਫੜੇ ਦੀ ਕਾਰਗੁਜ਼ਾਰੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਦਾ ਜ਼ਿਆਦਾ ਭਰਮਾਰ ਵੱਧਦਾ ਹੀ ਰਹਿੰਦਾ ਹੈ ਜੋ ਕਿ ਸਾਡੇ ਸਰੀਰ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ ਸਾਡੇ ਸਮੁੱਚੇ ਸਿਹਤ ਨੂੰ ਬਿਹਤਰ ਹੀ ਵਧਾਉਂਦਾ ਰਹਿੰਦਾ ਹੈ ਦੌੜਨ ਨਾਲ ਬਹੁਤ ਹੀ ਜ਼ਿਆਦਾ ਸਰੀਰ ਨੂੰ ਆਰਾਮ ਮਿਲਦਾ ਰਹਿੰਦਾ ਹੈ ਇਸ ਨਾਲ ਸਾਡਾ ਮਾਨਸਿਕ ਫੋਕਸ ਦੀ ਵੱਧਦਾ ਹੈ ਜਿਵੇਂ ਕਿ ਦੌੜਦੇ ਹਾਂ ਤਾਂ ਹਮੇਸ਼ਾ ਸਾਡੇ ਸਰੀਰ ਨੂੰ ਤਰੋ ਤਾਜ਼ਾ ਰੱਖਦਾ ਹੈ ਨਵੀਨਤਮ ਦੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਅਸੀਂ ਆਪਾਂ ਸਰੀਰਕ ਸ ਤੰਦਰੁਸਤੀ ਲਈ ਸਮੇਂ ਸਮੇਂ ਅਨੁਸਾਰ ਸਰੀਰਕ ਵਿਕਾਸ ਵੱਧਦਾ ਫੁੱਲਦਾ ਰਹਿੰਦਾ ਹੈ ਮਾਨਸਿਕ ਫੋਕਸ ਵੀ ਵੱਧਦਾ ਹੈ ਦੌੜਨ ਨਾਲ ਸਾਡਾ ਮਨ ਹਮੇਸ਼ਾ ਤਰੋ ਤਾਜ਼ਾ ਰਹਿੰਦਾ ਹੈ ਸਹਿਣਸ਼ਕਤੀ ਵੱਧਦੀ ਹੀ ਰਹਿੰਦੀ ਹੈ ਜਿਸ ਨਾਲ ਸਾਡਾ ਸਰੀਰ ਝਲਕਾਂ ਤੋਂ ਬਚਾਓ ਹੀ ਹੁੰਦਾ ਹੈ ਦੌੜਨ ਤੋਂ ਬਾਅਦ ਆਰਾਮ ਕਰਨਾ ਸਿੱਧੇ ਪ੍ਰਭਾਵ ਸਰੀਰਕ ਤੌਰ 'ਤੇ ਪਸੀਨਿਆਂ ਅਤੇ ਥਕਾਵਟ ਦੇ ਬਾਵਜੂਦ ਦੌੜਣ ਤੋਂ ਬਾਅਦ ਸਾਡੇ ਸਰੀਰਕ ਠੰਡਕ ਤਾਜ਼ਗੀ ਦਾ ਅਨੁਭਵ ਆਉਣ ਲੱਗਦਾ ਹੈ ਜੋ ਕਿ ਹਮੇਸ਼ਾ ਸਾਰੀਆਂ ਸਮੱਸਿਆਵਾਂ ਦੇ ਤਨਾਓ ਨੂੰ ਠੰਡਾ ਕਰਦਾ ਹੀ ਰਹਿੰਦਾ ਹੈ ਸਾਡਾ ਮੂਡ ਹਮੇਸ਼ਾ ਸੁਧਰਦਾ ਹੀ ਰਹਿੰਦਾ ਹੈ ਦੌੜਨ ਨਾਲ ਡਿਪਰੈਸ਼ਨ ਅਤੇ ਹੋਰ ਨਿਮਰਤਾਵਾਂ ਸਮੱਸਿਆਵਾਂ ਨੂੰ ਘਟਾ ਸਕਦਾ ਹੈ ਜੋ ਕਿ ਜੀਵਨ ਦੀ ਹਮੇਸ਼ਾ ਕੁਲ ਪ੍ਰਣਾਲੀ ਨੂੰ ਹੀ ਸੁਧਾਰਦਾ ਰਹਿੰਦਾ ਹੈ ਜਿਸ ਨਾਲ ਵਧੀਆ ਨੀਂਦ ਆਉਂਦੀ ਹੈ ਸਰੀਰਕ ਵਿਕਾਸ ਵੀ ਬਹੁਤ ਜ਼ਿਆਦਾ ਦਿਨੋਂ ਦਿਨ ਵੱਧਦਾ ਹੀ ਜਾਂਦਾ ਹੈ ਧੰਨਵਾਦ